ਅ ਅਤੇ ਅਸੀਂ ਸੋਲ੍ਹਾਂ ਸਾਲ ਸਤਾਰ੍ਹਾਂ ਸਾਲ ਵਾ ਅਸ ਪਹਿਲਾਂ ਮਾਲੀ ਦੇ ਵਿੱਚ ਕੰਮ ਕਰਦੇ ਸੀ ਕਾਲਜ ਦੇ ਵਿੱਚ ਅਤੇ ਸਾਨੂੰ ਹੁਣ ਸੌਲ੍ਹਾਂ ਸਤਾਰ੍ਹਾਂ ਸਾਲ ਹੋ ਗਏ ਦੋ ਤਿੰਨ ਸਾਲ ਮਗਰੋਂ ਸਾਨੂੰ ਵਰਕਸ਼ਾਪ ਦੇ ਵਿੱਚ ਰੱਖਿਆ ਗਿਆ ਹੈਲਪਰ ਦੀ ਪੋਸਟ 'ਤੇ ਅਤੇ ਅਸੀਂ ਬੈਲਡਿੰਗ ਦੇ ਬਿਲਡਿੰਗ ਸ਼ੋਪ ਦੇ ਵਿੱਚ ਮੈਨੂੰ ਢਿੱਗ ਅਤੇ ਮਿਕ ਆਰਕ ਬੈਲਡਿੰਗ ਸਾਰੀਆਂ ਹੀ ਚਲਾਉਣੀਆਂ ਆਉਂਦੀਆਂ ਨੇ ਅਸੀਂ ਬਹੁਤ ਪ੍ਰੇਮ ਅਤੇ ਬਹੁਤ ਕੁਛ ਬਣਾਇਆ ਉੱਥੇ ਜਿਵੇਂ ਕੋਈ ਵੀ ਚੀਜ਼ ਬਣਾਉਣੀ ਹੈ ਤਾਂ ਸਾਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਬਣਾਉਣੀ ਆਉਂਦੀ ਹੈ ਮਸ਼ੀਨ ਸ਼ੋਪ ਦੇ ਵਿੱਚ ਵੀ ਅਸੀਂ ਜੋਬ ਜਿਹੜੀ ਬਣਦੀ ਹੈ ਉਹ ਵੀ ਬਣਾ ਲੈਂਦੇ ਹਾਂ ਅਤੇ ਫਿਟਿੰਗ ਸ਼ੋਪ ਦੇ ਵਿੱਚ ਜਿਵੇਂ ਵੀ ਕੋਈ ਜੋਬ ਬਣਾਉਣੀ ਆ ਉਹਨੂੰ ਉਹਦਾ ਸਕੇਲ ਬਣਾਉਣਾ ਉਹ ਵੀ ਬਣਾ ਲੈਂਦੇ ਹਾਂ ਅਤੇ ਸਮਿਤੀ ਸ਼ੋਪ ਦੇ ਵਿੱਚ ਜਿਵੇਂ ਕੋਈ ਭੱਠੀ ਅਤੇ ਕੋਈ ਲੋਹੇ ਨੂੰ ਕੁੱਟ ਕੇ ਉਹਨੂੰ ਦਸ ਐੱਮ ਤੋਂ ਵੀਹ ਐੱਮ ਐੱਮ ਕਰਨਾ ਉਹ ਵੀ ਅਸੀਂ ਕਰ ਲੈਂਦੇ ਹਾਂ ਅਤੇ ਕਾਰਪੈਂਟਰੀ ਦੇ ਵਿੱਚ ਜਿਵੇਂ ਰੰਦਾ ਲਾਉਣਾ ਜਾਂ ਆਰੀ ਨਾਲ ਕੋਈ ਚੀਜ਼ ਕੱਟ ਕੇ ਬਣਾਉਣੀ ਅਤੇ ਉਹਨਾਂ ਨੂੰ ਰੈਸਕ ਫੈਲ ਨਾਲ ਸਹੀ ਕਰਨਾ ਅਤੇ ਸਾਨੂੰ ਉਹਨਾਂ ਨੂੰ ਪੱਕਾ ਕਰਨ ਪੱਕਾ ਹਾਲੇ ਤੱਕ ਪੱਕਾ ਨਹੀਂ ਕੀਤਾ ਸੀ ਪਰ ਅਸੀਂ ਆਪਣੀ ਆਸ ਲੈ ਕੇ ਚੱਲ ਰਹੇ ਹਾਂ ਸਾਡੀ ਤਨਖਾਹ ਸਾਨੂੰ ਕੰਟਰੈਕਟ ਪੰਦਰ੍ਹਾਂ ਸੋਲ੍ਹਾਂ ਸਾਲ ਮਗਰੋਂ ਕੰਟਰੈਕਟ ਦਿੱਤਾ ਅਤੇ ਸਾਡੀ ਤਨਖਾਹ ਹਾਲੇ ਉਹੀ ਸੱਤ ਹਜ਼ਾਰ ਹੈ ਇਸ ਕਰਕੇ ਅਸੀਂ ਆਸ ਰੱਖਦੇ ਹਾਂ ਵੀ ਸਾਡਾ ਕੁਛ ਉਰੇ ਬਣ ਜਾਵੇ